ਹਾਂਜੀ ਅਸੀਂ ਆਪਣਾ ਸਾਡਾ ਤਾਂ ਜੀ ਸਾਰਾ ਬੱਚਿਆਂ ਦਾ ਜਨਮਦਿਨ ਸਪੈਸ਼ਲ ਅਸੀਂ ਪਰਿਵਾਰ ਦੇ ਵਿੱਚ ਮਨਾਉਂਦੇ ਹਾਂ ਬੈਠ ਕੇ ਸਾਰੇ ਅਤੇ ਘਰ ਦੇ ਵਿੱਚ ਕੋਈ ਵਧੀਆ ਆਪਣੇ ਹੱਥੀਂ ਕੋਈ ਚੀਜ਼ ਬਣਾਈ ਜਾਂਦੀ ਹੈ ਸਾਰਿਆਂ ਵਾਸਤੇ ਖਾਣ ਵਾਸਤੇ ਠੀਕ ਹੈ ਸਾਰੇ ਬੱਚੇ ਵੱਡੇ ਬਜ਼ੁਰਗ ਬੈਠਦੇ ਹੈ ਠੀਕ ਹੈ ਚਲੋ ਬੱਚਿਆਂ ਵਾਸਤੇ ਕੇਕ ਹੋਰ ਸਮਾਨ ਜੋ ਵੀ ਹੈ ਉਹਨਾਂ ਦੇ ਮਨ ਪਸੰਦ ਦੀਆਂ ਚੀਜ਼ਾਂ ਹੁੰਦੀਆਂ ਖਾਣ ਦੀਆਂ ਉਹ ਸਾਰੀਆਂ ਲੈ ਕੇ ਆਉਂਦੇ ਹਾਂ ਬਣਾਉਣੇ ਹਾਂ ਵਧੀਆ ਤਾਂ ਮੀਨਜ਼ ਵਧੀਆ ਲੱਗਦਾ ਸਾਰੀ ਫੈਮਲੀ ਬੈਠਦੀ ਹੈ ਠੀਕ ਹੈ ਉਹਨੂੰ ਇਨਜੋਏ ਕਰਦੀ ਹੈ ਤਾਂ ਮੈਨੂੰ ਲੱਗਦਾ ਹਰ ਇੱਕ ਪ੍ਰੋਗਰਾਮ ਨੂੰ ਇੱਦਾਂ ਹੀ ਕਰਨਾ ਚਾਹੀਦਾ ਠੀਕ ਹੈ ਜਨਮਦਿਨ ਤਾਂ ਖ਼ਾਸ ਕਰਕੇ ਵਿਆਹ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਦੇਖ ਕੇ ਚੰਗਾ ਲੱਗਦਾ ਹੈ ਠੀਕ ਹੈ ਉਹਦੇ ਵਿੱਚ ਹੀ ਆਪਾਂ ਨੂੰ ਵਧੀਆ ਲੱਗਦਾ ਹੈ ਦੁੱਖ ਸੁੱਖ ਸਾਂਝੇ ਹੋ ਜਾਂਦੇ ਹੈ ਆਪਾ ਇੱਕ ਦੂਜੇ ਨੂੰ ਮਿਲ ਲੈਂਦੇ ਹਾਂ ਇਸ ਤਰ੍ਹਾਂ ਇਹਨਾਂ ਦਾ ਟਾਈਮ ਨਹੀਂ ਹੁੰਦਾ ਕਿਸੇ ਕੋਲ ਕੋਈ ਇੰਨਾ ਵੀ ਉਠ ਕੇ ਜਸ਼ਨਾਂ ਦੇ ਵਿੱਚ ਹੀ ਆਪਾਂ ਸਾਰੇ ਇੱਕ ਦੂਸਰੇ ਨੂੰ ਮਿਲਦੇ ਹਾਂ ਠੀਕ ਹੈ ਮਿਲ ਜੁਲ ਕੇ ਰਹਿੰਦੇ ਹਾਂ ਵਧੀਆ ਲੱਗਦਾ ਹੱਸਦੇ ਖੇਡਦੇ ਹੈ ਠੀਕ ਹੈ ਦੂਜਿਆਂ ਨਾਲ ਮਿਲਣ ਦਾ ਟਾਈਮ ਮਿਲਦਾ ਹੈ ਕਿ ਵਧੀਆ ਲੱਗਦਾ ਵੀ ਸਭ ਨੂੰ ਮਿੱਠੇ ਬਣ ਕੇ ਰਲ ਕੇ ਹੀ ਸਭ ਕੁਛ ਬਣਾਉਣਾ ਚਾਹੀਦਾ ਹੈ